ਮੈਂ ਪੇਂਟਿੰਗ ਕਰਨ ਲਈ ਬਹੁਤ ਸ਼ਾਂਤ ਮਾਹੌਲ ਲੱਭਦੀ ਹਾਂ ਇੱਕ ਮੇਰਾ ਰੂਮ ਹੈਗਾ ਜਿੱਥੇ ਮੈਂ ਆਪਣਾ ਸਾਰਾ ਸਮਾਨ ਰੱਖਿਆ ਹੋਇਆ ਉੱਥੋਂ ਦੀ ਮੈਂ ਸਾਰਾ ਸਮਾਨ ਲੈ ਕੇ ਮੈਂ ਵਿਊ ਦੇਖਦੀ ਹਾਂ ਕਿੱਥੇ ਚੰਗਾ ਵਿਊ ਆ ਰਿਹਾ ਵਾ ਜੇ ਕੋਈ ਚੀਜ਼ ਚੰਗੀ ਲੱਗਦੀ ਹੈ ਜਿਵੇਂ ਪੰਛੀ ਹੋ ਗਏ ਧੁੱਪੇ ਬੈਠੇ ਹਾਂ ਸਾਨੂੰ ਕੋਈ ਚੀਜ਼ ਆਕਰਸ਼ਿਤ ਕਰ ਰਹੀ ਆ ਆਪਣੀ ਔਰ ਮੈਂ ਉਹਨੂੰ ਲੈ ਕੇ ਬਹਿ ਜਾਦੀ ਹਾਂ ਅਤੇ ਉਹਨੂੰ ਮੈਂ ਪੇਂਟ ਕਰਨ ਲੱਗ ਜਾਦੀ ਹਾਂ ਜਿਹਦੇ ਨਾਲ ਮੈਨੂੰ ਬਹੁਤ ਸੁਕੂਨ ਮਿਲਦਾ ਹੈ ਜਿੰਨਾਂ ਮੈਨੂੰ ਅੰਦਰ ਠੰਡਕ ਮਿਲ ਜਾਂਦੀ ਹੈ ਕਿ ਰੱਬ ਨੇ ਇੰਨੀ ਸੋਹਣੀ ਕਲਾ ਦਿੱਤੀ ਹੈ ਮੇਰੇ ਚ ਜਿਹਨੂੰ ਕਿ ਸਾਨੂੰ ਦਿਖਾਉਣਾ ਚਾਹੀਦਾ ਹੈ ਲੋਕਾਂ ਨੂੰ ਅਤੇ ਜਿੰਨਾ ਲੋਕਾਂ ਨੂੰ ਵੀ ਖੁਸ਼ੀ ਮਿਲੇ ਅਤੇ ਸਾਨੂੰ ਵੀ ਖੁਸ਼ੀ ਮਿਲੇ ਦੇਖ ਕੇ ਕਿ ਰੱਬ ਨੇ ਇੰਨੀ ਸੋਹਣੀ ਕਲਾ ਦਿੱਤੀ ਆ ਸਾਨੂੰ ਪੇਂਟਿੰਗ ਦੀ ਅਤੇ ਮੈਂ ਸਾਰਾ ਸਮਾਨ ਵਧੀਆ ਕੁਆਲਿਟੀ ਦਾ ਯੂਜ਼ ਕਰਦੀ ਹਾਂ ਪੇਂਟਿੰਗ ਦੇ ਵਿੱਚ ਅਤੇ ਮੈਨੂੰ ਇਹਦੇ ਵਿੱਚ ਬਹੁਤ ਇਨਾਮ ਮਿਲੇ ਹਨ ਮੈਨੂੰ ਸਕੂਲ ਤੋਂ ਲੈ ਕੇ ਮੇਰੇ ਕਾਲਜ ਤੱਕ ਹਮੇਸ਼ਾ ਫਰਸਟ ਪ੍ਰਾਈਜ਼ ਪਹਿਲੇ ਨਤੀਜੇ 'ਤੇ ਪ੍ਰਾਈਜ਼ ਮਿਲਿਆ ਅਤੇ ਮੇਰੀਆਂ ਸਾਰੀਆਂ ਮੈਡਮਾਂ ਅਤੇ ਸਾਰੀਆਂ ਕਾਲਜ ਦੀਆਂ ਮੈਡਮਾਂ ਮੇਰੀ ਤਾਰੀਫਾਂ ਕਰਦੀਆਂ ਸਨ ਕਿ ਇਹ ਬੱਚੇ ਦੇ ਹੱਥ 'ਚ ਰੱਬ ਨੇ ਬਹੁਤ ਵਧੀਆ ਕਲਾ ਦਿੱਤੀ ਹੈ ਪੇਂਟਿੰਗ ਦੀ ਮੈਂ ਬਹੁਤ ਜ਼ਿਆਦਾ ਮੈਂ ਕਿਸੇ ਵੀ ਬੰਦੇ ਦੀ ਸ਼ਕਲ ਵੀ ਬਣਾ ਸਕਦੀ ਹਾਂ ਮੈਂ ਇੱਕ ਗੁਰਦੁਆਰਾ ਹਰਿਮੰਦਰ ਸਾਹਿਬ ਬਣਾਏ ਸੀਗੇ ਜਿਸ ਵੱਲੋਂ ਮੈਨੂੰ ਬਹੁਤ ਵਾਹ ਵਾਹੀ ਮਿਲੀ ਲੋਕਾਂ ਕੋਲੋਂ ਜਿਸ ਨਾਲ ਮੇਰਾ ਮਨ ਖੁਸ਼ ਹੋ ਗਿਆ ਅਤੇ ਮੈਂ ਰੱਬ ਨੂੰ ਸ਼ੁਕਰਾਨਾ ਕੀਤਾ ਕਿ ਤੁਸੀਂ ਮੈਨੂੰ ਇੰਨੀ ਵਿਦਿਆ ਵਧੀਆ ਕਲਾ ਦਿੱਤੀ ਆ ਮੇਰੇ ਹੱਥ ਦੇ ਵਿੱਚ